ਸਤਿ ਸ਼੍ਰੀ ਅਕਾਲ ਜੀ ਮੇਰਾ ਨਾਂ ਤੇਜਪਾਲਜੀਤ ਸਿੰਘ ਆ ਅਤੇ ਪੰਜਾਬੀ ਭਾਸ਼ਾ ਸਾਡੇ ਰਾਜ ਪੰਜਾਬ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਹੈ ਕਿਉਂਕਿ ਪੰਜਾਬੀ ਸਾਡੀ ਮਾਤ ਭਾਸ਼ਾ ਹੈ ਇੱਥੋਂ ਦਾ ਹਰ ਬੱਚਾ ਬੱਚਾ ਹਰ ਬਜ਼ੁਰਗ ਹਰ ਜਵਾਨ ਹਰ ਮਰਦ ਔਰਤ ਪੰਜਾਬੀ ਬੋਲਦਾ ਹੈ ਕਿਉਂਕਿ ਪੰਜਾਬੀ ਸਾਡੇ ਰਗ ਰਗ ਵਿੱਚ ਵਸੀ ਹੋਈ ਹੈ ਸਾਡੇ ਗੁਰੂਆਂ ਪੀਰਾਂ ਤੋਂ ਸਾਨੂੰ ਪੰਜਾਬੀ ਇੱਕ ਤੋਹਫੇ ਦੇ ਰੂਪ ਵਿੱਚ ਮਿਲੀ ਹੋਈ ਹੈ ਅਤੇ ਸਾਡੀ ਸਿੱਖਿਆ ਪ੍ਰਣਾਲੀ 'ਤੇ ਪੰਜਾਬੀ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਹੈ ਪੰਜਾਬ ਦੀ ਸਰਕਾਰ ਨੇ ਛੋਟੀ ਜਮਾਤਾਂ ਤੋਂ ਹੀ ਹਰ ਹਰ ਇੱਕ ਜਮਾਤ ਨੂੰ ਪੰਜਾਬੀ ਭਾਸ਼ਾ ਲਾਜ਼ਮੀ ਕੀਤੀ ਹੋਈ ਹੈ ਕਿ ਹਰ ਬੱਚਾ ਪੰਜਾਬੀ ਭਾਸ਼ਾ ਸਿੱਖੇ ਅਤੇ ਆਪਣੀ ਮਾਤ ਭਾਸ਼ਾ ਨੂੰ ਨਾ ਭੁੱਲੇ ਇਹ ਜ਼ਰੂਰੀ ਵੀ ਹੈ ਕਿ ਪੰਜਾਬ ਦਾ ਹਰ ਇੱਕ ਨਿਵਾਸੀ ਹਰ ਇੱਕ ਹਰ ਜਗ੍ਹਾ ਰਹਿਣ ਵਾਲਾ ਨਿਵਾਸੀ ਇਹ ਭਾਸ਼ਾ ਜਾਣਦਾ ਹੋਵੇ ਅਤੇ ਬੋਲਣੀ ਆਉਂਦੀ ਹੋਵੇ ਇਸ ਨਾਲ ਹੀ ਸਾਡੀ ਪਹਿਚਾਣ ਹੈ ਜਿਸ ਰਾਹੀਂ ਪਤਾ ਲੱਗਦਾ ਹੈ ਅਸੀਂ ਪੰਜਾਬ ਦੇ ਹਾਂ ਅਤੇ ਪੰਜਾਬੀ ਸਾਡੀ ਮਾਤ ਭਾਸ਼ਾ ਹੈ ਸਾਨੂੰ ਪੰਜਾਬੀ ਕਦੇ ਨਹੀਂ ਭੁੱਲਣੀ ਚਾਹੀਦੀ ਅਤੇ ਪੰਜਾਬੀ ਸਾਨੂੰ ਲਾਜ਼ਮੀ ਆਉਣੀ ਹੀ ਚਾਹੀਦੀ ਹੈ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਵੀ ਹਰ ਸਾਲ ਨਵੀਂ ਤੋਂ ਨਵੀਂ ਪੰਜਾਬੀ ਪੰਜਾਬੀ ਦੀਆਂ ਕ ਪੁਸਤਕਾਂ ਆਉਂਦੀਆਂ ਹਨ ਪ ਸਾਨੂੰ ਪੁਸਤਕਾਂ ਵੀ ਪੰਜਾਬੀ ਵਿੱਚ ਪੜ੍ਹਨੀਆਂ ਚਾਹੀਦੀਆਂ ਹਨ ਪੁਸਤਕਾਂ ਵਿੱਚ ਵੀ ਸਾਨੂੰ ਦੱਸਿਆ ਗਿਆ ਕਿ ਪੰਜਾਬੀ ਪੜ੍ਹਨਾ ਬਹੁਤ ਜ਼ਰੂਰੀ ਹੈ ਸਾਡੀਆਂ ਕਈ ਪੁਸਤਕਾਂ ਪੰਜਾਬੀ ਪੰਜਾਬੀ ਵਿਸ਼ੇ ਵਿੱਚ ਹੁੰਦੀਆਂ ਹਨ ਕਾਫੀ ਜਿਹੜੇ ਕਿ ਸਾਨੂੰ ਪੜ੍ਹਨ ਵਿੱਚ ਲ ਕੰਮ ਆਉਂਦੀਆਂ ਹਨ ਅਤੇ ਇਹ ਬਹੁਤ ਜ਼ਰੂਰੀ ਹਨ ਸਾਡੀ ਸਿੱਖਿਆ ਸਿੱਖਿਆ ਮੰਤਰੀ ਜੋ ਵੀ ਹਨ ਉਹ ਸਾਨੂੰ ਦੱਸਦੇ ਹਨ ਕਿ ਪੰਜਾਬੀ ਬਹੁਤ ਲਾਜ਼ਮੀ ਹੈ ਇਸ ਲਈ ਸਾਨੂੰ ਹਮੇਸ਼ਾ ਪੰਜਾਬੀ ਸਿੱਖਣੀ ਚਾਹੀਦੀ ਹੈ ਜੋ ਕਿ ਬਹੁਤ ਜ਼ਰੂਰੀ ਹੈ ਅਤੇ ਸਾਨੂੰ ਸਾਡੀ ਮਾਤ ਭਾਸ਼ਾ ਬਾਰੇ ਪਤਾ ਹੋਣਾ ਚਾਹੀਦਾ ਹੈ ਧੰਨਵਾਦ